ਪੰਜਾਬ ਦੀ ਬਹੁਤ ਹੀ ਪ੍ਰਸਿੱਧ ਅਤੇ ਪੁਰਾਣੀ ਰਸਮ ਛਿੰਝ ਮੇਲਾ ਹੈ ਪੰਜਾਬ ਦੇ ਵੱਖੋ ਵੱਖ ਪਿੰਡ ਜਿੰਨੇ ਵੀ ਪਿੰਡ ਪੈ ਜਾਂਦੇ ਹਨ ਸਾਰੇ ਵਿੱਚ ਛਿੰਝ ਮੇਲਾ ਕਰਾਇਆ ਜਾਂਦਾ ਹੈ ਇਹ ਛਿੰਝ ਮੇਲਾ ਪੰ ਪਿੰਡ ਵਿੱਚ ਰਹਿੰਦੇ ਲੋਕਾਂ ਦੇ ਮਾਲ ਡੰਗਰਾ ਦੇ ਨਾਲ਼ ਸੰਬੰਧਿਤ ਹੈ ਇਹ ਇਹ ਡੰਗਰਾ ਦੀ ਸੁੱਖ ਸ਼ਾਂਤੀ ਮੈਸ ਮੈਸਾਂ ਗਾਇਆਂ ਦੀ ਸੁੱਖ ਸ਼ਾਂਤੀ ਵਾਧ ਦੁੱਧ ਦੇ ਵਾਧੇ ਲਈ ਉਨ੍ਹਾਂ ਦੀ ਫੁਲਾਵਟ ਲਈ ਇਹ ਮੇਲਾ ਕਰਵਾਇਆ ਜਾਂਦਾ ਹੈ ਇਹ ਛਿੰਝ ਮੇਲਾ ਹਰ ਸਾਲ ਭਾਦੋਂ ਅੱਸੂੂ ਦੇ ਮਹੀਨੇ ਦੇ ਸ਼ੁਰੂ ਲਗਪਗ ਸ਼ੁਰੂ ਹੁੰਦਾ ਹੈ ਅਤੇ ਕੁਝ ਪਿੰਡ ਕੁਝ ਪਿੰਡਾਂ ਵਿੱਚ ਕੁਝ ਪਿੰਡਾਂ ਵਿੱਚ ਇਹ ਕੱਤਕ ਪੋਹ ਦੇ ਮਹੀਨੇ ਵਿੱਚ ਵੀ ਪੋਹ ਦੇ ਮਹੀਨੇ ਵਿੱਚ ਤਾਂ ਘੱਟ ਕੱਤਕ ਦੇ ਮਹੀਨੇ 'ਚ ਵੀ ਕਰਵਾਇਆ ਜਾਂਦਾ ਹੈ ਜਿਵੇਂ ਕਿ ਮੰਨ ਲਉ ਨਵੰਬਰ ਦੇ ਮਹੀਨੇ ਵਿੱਚ ਜਦੋਂ ਸਮਾਪਤੀ ਹੋਣ ਲੱਗ ਜਾਂਦੀ ਹੈ ਕਬੱਡੀ ਮੇਲੇ ਵੀ ਕਰਵਾਏ ਜਾਂਦੇ ਹਨ ਅਤੇ ਇਹ ਤਾਂ ਚਲੋ ਠੰਡਾਂ ਵਿੱਚ ਵੀ ਹੁੰਦੇ ਰਹਿੰਦੇ ਹਨ ਛਿੰਝ ਮੇਲਾ ਦੇਖਿਆ ਜਾਵੇ ਬਹੁਤ ਹੀ ਪੁਰਾਣੀ ਰਸਮ ਹੈ ਸਾਡੇ ਬਜ਼ੁਰਗ ਇਸ ਰਸਮ ਨੂੰ ਅਰੰਭਿਆ ਹੈ ਅਤੇ ਹੌਲ਼ੀ ਹੌਲ਼ੀ ਅੱਗੇ ਹੁਣ ਨਵੀਆਂ ਨਵੀਆਂ ਕਮੇਟੀਆਂ ਆਈ ਜਾਂਦੀਆਂ ਹੈ ਭਲਵਾਨ ਵੀ ਬਹੁਤ ਪ੍ਰਸਿੱਧ ਹਨ ਅਤੇ ਭਲਵਾਨ ਆਪਣੀ ਮਿਹਨਤ ਦੇ ਸਦਕਾ ਆਪਣੇ ਜੋਹਰ ਦਿਖਾਉਂਦੇ ਹਨ ਛਿੰਝ ਮੇਲੇ ਦੇ ਵਿੱਚ ਛਿੰਝ ਮੇਲਾ ਦੇਖਣ ਬਹੁਤ ਸਾਰੇ ਲੋਕ ਦੂਰ ਦੂਰ ਤੋਂ ਆਉਂਦੇ ਹਨ ਕਿਉਂਕਿ ਇਹ ਪੰਜਾਬ ਦੀ ਇੱਕ ਮਿੱਟੀ ਦੀ ਮਿੱਟੀ ਵਿੱਚ ਘੋਲ਼ ਕੀਤਾ ਜਾਂਦਾ ਹੈ ਅ ਅੱਜ ਕੱਲ੍ਹ ਤਾਂ ਉਲੰਪਿਕ ਦੇਖਿਆ ਜਾਵੇ ਤਾਂ ਉਲੰਪਿਕ 'ਚ ਮੈਟਾਂ 'ਤੇ ਹੁੰਦੇ ਹਨ ਉਹ ਛੇ ਮਿੰਟ ਦੀ ਗੇਮ ਹੁੰਦੀ ਹੈ ਪਰ ਇਸ ਲਈ ਮਿੱਟੀ ਦੇ ਘੋਲ਼ ਵਾਸਤੇ ਵੀਹ ਮਿੰਟ ਆਖਰ ਨੂੰ ਵੀਹ ਮਿੰਟ ਭਿੜਨਾ ਇੱਕ ਜ਼ੋਰ ਵਾਲੀ ਗੱਲ ਹੈ ਮਿੱਟੀ ਦੇ ਵਿੱਚ ਇਸ ਨੂੰ ਦੇਖਣ ਦੇ ਲਈ ਲੋਕ ਆਉਂਦੇ ਹਨ ਅਤੇ ਆ ਵੀ ਸਕਦੇ ਹਨ